ਫਿਊਜ਼ਨ ਅਨੈਥਿਕਸ ਇਹ ਇੱਕ ਸੰਕਲਪ ਹੈ ਜੋ ਵੱਖ ਵੱਖ ਸੰਸਕ੍ਰਿਤਾਂ ਰਵਾਇਤਾਂ ਅਤੇ ਸ਼ੈਲੀਆਂ ਦੇ ਮਿਲਾਪ ਨੂੰ ਦਰਸਾਉਂਦਾ ਹੈ ਇਹ ਇੱਕ ਤਰਹਾਂ ਦੀ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਰਿਵਾਇਤੀ ਅਤੇ ਆਧੁਨਿਕ ਤੱਤ ਤੇ ਸਾਰੇ ਇਕੱਠੇ ਹੁੰਦੇ ਹਨ ਨਵੀਆਂ ਪਹਿਚਾਨਾ ਬਣਾਉਂਦੇ ਹਨ ਸਮਾਜਿਕ ਤੇ ਸਭਿਆਚਾਰ ਨੂੰ ਵਧਾਉਂਦੇ ਹਨ ਅਸੀਂ ਪੰਜਾਬੀ ਸੰਗੀਤ ਅਤੇ ਭੰਗੜੇ ਨਾਰਸ ਦੀ ਗੱਲ ਕਰਦੇ ਹਾਂ ਦੋਵੇਂ ਪਹਿਚਾਨਾ ਦੋਵੇਂ ਪਹਿਚਾਨਾ ਤੇ ਉਸਤਾਦ ਦਾ ਪ੍ਰਤੀਕ ਹਨ ਪੰਜਾਬੀ ਲੋਕ ਸੰਗੀਤ ਅਤੇ ਭੰਗੜੇ ਨਗਾੜੇ ਡੁਬੀਆਂ ਚਮਟੇ ਤੇ ਢੋਲ ਦੀਆਂ ਧੁਨੀਆਂ ਇੱਕ ਵਿਅਕਤੀਗਤ ਤੇ ਸਮੂਹਕ ਭਾਵਨਾਵਾਂ ਨੂੰ ਉਭਾਰਦਾ ਹੈ ਜੋ ਕਿ ਕਲਾਤਮਕ ਪ੍ਰਦਰਸ਼ਨ ਵਿੱਚ ਜੋਸ਼ ਤੇ ਉਤਸ਼ਾਹ ਪੈਦਾ ਕਰਦਾ ਹੈ ਜਦੋਂ ਇਹ ਨਿਆਵਤ ਤੱਤ ਹੋਰ ਕਲਾਵਾਂ ਅਤੇ ਸੰਸਕ੍ਰਿਤੀਆਂ ਨਾਲ ਮਿਲਦੇ ਹਨ ਤਾਂ ਇੱਕ ਨਵੀਂ ਰਚਾਤਮਕ ਦਿਸ਼ਾ ਬਣਦੀ ਹੈ ਉਦਾਹਰਨ ਦਈਏ ਤਾਂ ਜਦੋਂ ਭੰਗੜਾ ਪਚਿਮ ਹਿਪਹੋਪ ਜਾ ਮਿਊਜਿਕ ਨਾਲ ਮਿਲਦਾ ਹੈ ਤਾਂ ਉਹ ਇਕ ਨਵੀਂ ਸੰਸਕ੍ਰਿਤੀ ਸ਼ੈਲੀ ਉਪਜਦੀ ਹੈ ਜੋ ਨਾ ਸਿਰਫ ਆਤਮਿਕ ਯੋਗਾ ਪੀੜੀ ਨੂੰ ਪਸੰਦ ਆਉਂਦੀ ਹੈ ਨਾਲ ਦੀ ਨਾਲ ਪੰਜਾਬ ਵੀ ਸੰਗੀਤ ਨੂੰ ਵੀ ਵਿਸ਼ੇਸ਼ ਪੱਧਰ ਤੇ ਹੋਰ ਪ੍ਰਸਿੱਧੀ ਦੁਲਾਨ ਵਿੱਚ ਮਦਦਗਾਰ ਸਾਬਤ ਹੋਈ ਇਸੇ ਤਰੀਕੇ ਨਾਲ ਫਿਊਜ਼ਨ ਪਨੈਥਿਕ ਸਿਰਫ ਕਲਾਤਮਕ ਵਿਕਾਸ ਤੱਕ ਸੀਮਿਤ ਨਹੀਂ ਰਹਿੰਦਾ ਬਲਕਿ ਇਹ ਇਕ ਸੱਭਿਆਚਾਰ ਅਦਾਨ ਪ੍ਰਧਾਨ ਨੂੰ ਵੀ ਵਧਾਉਂਦਾ ਹੈ ਇਹ ਇੱਕ ਸਮਾਜ ਦੀ ਏਕਤਾ ਸਮਝਦਾਰੀ ਵਧਾਣ ਦਾ ਵੀ ਇਕ ਅਹਿਮ ਢੰਗ ਹੈ ਕਿਉਂਕਿ ਵੱਖ ਵੱਖ ਪਿਛੋਕੜ ਵਾਲੇ ਲੋਕਾਂ ਨੂੰ ਇਹ ਪਲੇਟਫਾਰਮ ਤੇ ਲਿਆਂਦਾ ਹੈ ਜਿੱਥੇ ਉਹ ਆਪਣੀ ਵਿਅਕਤੀਗਤ ਤੇ ਸਮੂਹਿਕ ਅਨੁਭਵ ਨੂੰ ਸ਼ੇਅਰ ਕਰ ਸਕਦਾ ਹੈ ਭਾਵੇਂ ਇੱਕ ਨਵਾਂ ਸੰਕਲਪ ਨਹੀਂ ਕਹਿ ਸਕਦੇ ਪਰ ਆਦਮੀ ਕੀ ਯੁਗ ਵਿੱਚ ਭਾਵੇਂ ਇੱਕ ਨਵਾਂ ਸੰਕਲਪ ਨਹੀਂ ਕਹਿ ਸਕਦੇ ਪਰ ਆਧੁਨਿਕ ਯੁੱਗ ਵਿੱਚ ਇਹਦੀ ਮਹੱਤਤਾ ਦਿਨ ਬ ਦਿਨ ਵਧਦੀ ਜਾਂਦੀ ਹੈ ਅੱਜ ਦੇ ਸਮੇਂ ਦੀ ਜੇ ਗੱਲ ਕਰਦੇ ਹਾਂ ਜਦੋਂ ਵਿਸ਼ਵ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ ਤੇ ਇਹ ਵੀ ਜਿਹੜਾ ਤਰੀਕਾ ਵਾ ਵਿਸ਼ਵ ਗਲੋਬਲਾਈਜੇਸ਼ਨ ਦੀ ਲਹਿਰ ਨਾਲ ਜੋੜਿਆ ਹੋਇਆ ਹੈ ਤੱਦ ਵੱਖ ਵੱਖ ਰਿਆ ਰਿਆਵਤਾਂ ਅਤੇ ਕਲਾਵਾਂ ਦੀ ਮਿਲਾਪ ਕਰਕੇ ਇੱਕ ਨਵਾਂ ਰੂਪ ਦੇਣ ਦੇਣਾ ਤੇ ਇੱਕ ਕਲਾਤਮਕ ਵਿਕਾਸ ਦਾ ਹਿੱਸਾ ਬਣ ਗਿਆ ਹੈ ਜਿਵੇਂ ਕੀ ਹਲਾਂਕੀ ਭਾਂਗੜਾ ਦੀ ਮੂਲ ਪਹਿਚਾਣ ਇਕ ਰਵਿਆਤੀ ਪੰਜਾਬੀ ਨਾਚ ਵਜੋਂ ਹੈ ਪਰ ਜਦੋਂ ਇਹ ਬੋਲੀਵੁੱਡ ਹਿਪਹੋਪ ਜਾਂ ਲੈਟਨਿਸ ਡਾਂਸ ਨਾਲ ਪਰਫੋਰਮ ਤੇ ਤੱਤਾ ਨਾਲ ਮਿਲਦਾ ਹੈ ਤਾਂ ਇਹੋ ਇਕ ਵਿਲੱਖਣ ਤੇ ਆਕਰਸ਼ਕ ਰੂਪ ਧਾਰਨ ਕਰ ਲੈਂਦਾ ਹੈ ਜੋ ਭਵਿੰਨ ਪਿਛੋਕੜ ਵਾਲੇ ਲੋਕਾਂ ਨੂੰ ਆਂਦਾ ਹੈ ਇਸੇ ਤਰੀਕੇ ਨਾਲ ਫਿਊਜ਼ਨ ਐਨਥਿਕ ਜਿਥੇ ਵੀ ਕਲਾਤਮਕ ਪ੍ਰਦਰਸ਼ਨ ਨੂੰ ਹੋਰ ਵਿਲੱਖਣ ਅਤੇ ਪ੍ਰਭਾਵਸ਼ਾਲੀ ਬਣਾਉਦਾ ਹੈ ਇਹ ਨਵੀਂ ਕਲਾਤਮਕ ਪਹਿਚਾਨ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਕਿ ਗਹਿਰਾਹੀ ਸਮਾਜਿਕ ਅਤੇ ਸੰਸਕ੍ਰਿਤਿਕ ਸਾਂਝ ਨੂੰ ਉਸਤਾਦ ਉਸਤਾਹ ਕ੍ਰਾਂਤੀ ਹੈ ਇਹ ਇੱਕ ਰਿਆਵਤ ਦੇ ਆਧੁਨਿਕ ਤੱਤਾਂ ਦੀ ਮਿਲਾਪ ਕਰਕੇ ਇਕ ਨਵਾਂ ਹੀ ਦ੍ਰਿਸ਼ਟੀਕੋਣ ਬਣ ਗਿਆ ਹੈ ਜੋ ਕਿ ਸਿਰਫ ਮਜ਼ੇਦਾਰ ਅਤੇ ਮਨੋਰੰਜਕ ਨਹੀਂ ਹੁੰਦਾ ਬਲਕਿ ਇਹ ਲੋਕਾਂ ਵਿੱਚ ਨਵੀਆਂ ਸੋਚਾਂ ਤੇ ਸਾਂਝ ਦੀ ਨੂੰ ਵੀ ਵਾਧਾ ਦਿੰਦਾ ਹੈ